ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਆਰਟੀਫਿਸ਼ਅਲ ਇੰਟੈਲੀਜੈਂਸ ਬਹੁਤ ਹੀ ਇੱਕ ਵੱਡਾ ਰੂਪ ਧਾਰਨ ਕਰ ਚੁੱਕੀ ਹੈ ਸਾਡੇ ਨਿੱਜੀ ਜੀਵਨ ਵਿੱਚ ਬੜਾ ਹੀ ਬਦਲਾਵ ਆ ਰਿਹਾ ਹੈ ਇਸ ਵਿੱਚ ਕਈ ਚੀਜ਼ਾਂ ਦਾ ਤਾਂ ਕੁਛ ਫਾਇਦਾ ਹੋ ਰਿਹਾ ਹੈ ਬਟ ਕਈ ਚੀਜ਼ਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਇਸ ਕਰਕੇ ਇਹਨਾਂ ਵਿੱਤੀ ਰੋਜ਼ਾਨਾ ਦੇ ਨਵੀਨਤਾਵਾਂ ਦਾ ਸਭ ਤੋਂ ਵੱਡਾ ਪ੍ਰਭਾਵ ਪਵੇਗਾ ਕੁਛ ਚੀਜ਼ਾਂ ਦੇ ਵਿੱਚ ਜਿਸ ਤਰ੍ਹਾਂ ਇਸ ਦਾ ਪ੍ਰਭਾਵ ਪੈਂਦਾ ਹੈ ਕਈ ਆਪਾਂ ਡਿਪਾਰਟਮੈਂਟ ਦੇਖ ਲਈਏ ਜਿਹਦੇ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਨੇ ਸਾਡੀ ਜ਼ਰੂਰਤਾਂ ਨੂੰ ਘੱਟ ਕਰ ਦਿੱਤਾ ਹੈ ਜਿੱਥੇ ਦਸ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ ਉੱਥੇ ਇੱਕ ਬੰਦਾ ਹੀ ਨੌਕਰੀ 'ਤੇ ਲਗਾਇਆ ਜਾਂਦਾ ਹੈ ਇਸ ਕਰਕੇ ਇਹ ਇਹ ਬਹੁਤ ਹੀ ਵੱਡਾ ਪ੍ਰਭਾਵ ਪੈ ਰਿਹਾ ਹੈ ਅਤੇ ਜੇ ਅਸੀਂ ਦੂਜੇ ਪਾਸੇ ਇਸ ਨੂੰ ਅੱਛੇ ਰੂਪ ਵਿੱਚ ਲੈ ਕੇ ਜਾਈਏ ਤਾਂ ਇਸ ਦਾ ਅੱਛਾ ਪ੍ਰਭਾਵ ਵੀ ਪੈ ਰਿਹਾ ਹੈ ਕਈ ਚੀਜ਼ਾਂ ਦੇ ਵਿੱਚ ਸਾਨੂੰ ਬਹੁਤ ਟਾਈਮ ਲੱਗਦਾ ਸੀਗਾ ਅਤੇ ਇਸ ਵਿੱਚ ਸਾਨੂੰ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਪੈਂਦੀ ਸੀ ਜਿੱਥੇ ਸਾਨੂੰ ਮੈਨਪਾਵਰ ਦੀ ਜ਼ਰੂਰਤ ਵੀ ਪੈਂਦੀ ਸੀ ਕੁਝ ਲੇਬਰ ਦੀ ਜ਼ਰੂਰਤ ਵੀ ਪੈਂਦੀ ਸੀ ਪਰ ਆਰਟੀਫਿਸ਼ਅਲ ਇੰਟੈਲੀਜੈਂਸ ਨੇ ਇਸ ਨੂੰ ਬਹੁਤ ਹੀ ਜ਼ਿਆਦਾ ਸਰਲ ਤਰੀਕੇ ਦੇ ਨਾਲ ਕਰ ਦਿੱਤਾ ਅਤੇ ਇਸ ਕਰਕੇ ਅਸੀਂ ਇਸ ਨੂੰ ਇੱਕ ਅੱਛਾ ਪ੍ਰਭਾਵ ਕਹਿ ਸਕਦੇ ਹਾਂ ਅਤੇ ਫਾਨੈਂਸ਼ੀਅਲ ਸਰਵਿਸ ਦੇ ਵਿੱਚ ਵੀ ਇਸ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਜਿਸ ਤਰ੍ਹਾਂ ਅੱਜ ਕੱਲ੍ਹ ਏਟੀਐਮ ਸਰਵਿਸ ਹੈ ਜਾਂ ਅਸੀਂ ਕਿਸੇ ਅੱਛੇ ਡਿਜੀਟਲ ਸਿਸਟਮ ਦੇ ਨਾਲ ਅਸੀਂ ਪੈਸੇ ਇੱਕ ਦੂਸਰੇ ਨੂੰ ਭੇਜ ਸਕਦੇ ਹਾਂ ਇਹ ਵੀ ਇੱਕ ਅੱਛਾ ਮਾਧਿਅਮ ਹੈ ਅਤੇ ਦੂਸਰੀ ਗੱਲ ਆਪਾਂ ਜੇ ਅਸੀਂ ਇਸ ਪਾਸੇ ਕਹਿੰਦੇ ਹਾਂ ਕਿ ਇਹਨਾਂ ਦੇ ਕੁਛ ਬੁਰੇ ਪ੍ਰਭਾਵ ਵੀ ਪੈ ਸਕਦੇ ਹਨ ਕਿ ਕੁਛ ਲੋਕ ਇਸ ਦਾ ਗਲਤ ਇਸਤੇਮਾਲ ਕਰਕੇ ਇਕ ਦੂਜੇ ਦੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲਵਾ ਲੈਂਦੇ ਹਨ ਕੁਛ ਫਰੇਬੀ ਬੰਦੇ ਜਿਹੜੇ ਇਸ ਨੂੰ ਗਲਤ ਵੇਅ ਦੇ ਗਲਤ ਤਰੀਕੇ ਦੇ ਨਾਲ ਇਸ ਨੂੰ ਪੇਸ਼ ਕਰਦੇ ਹਨ ਅਤੇ ਉਹ ਗਲਤ ਤਰੀਕਾ ਇਹਨਾਂ ਨੂੰ ਗਲਤ ਸਿਸਟਮ ਦੇ ਵਿੱਚ ਲਾ ਜਾਂਦਾ ਹੈ ਜਿਸ ਕਰਕੇ ਇਸ ਦਾ ਇੱਕ ਬੁਰਾ ਪ੍ਰਭਾਵ ਵੀ ਹੈ